ਅਸੀਂ ਅਕਸਰ ਸੋਸ਼ਲ ਮੀਡੀਆ ਜਾਂ ਹੋਰ ਪਲੈਟਫੋਮ ਹੈਕ ਹੋਣ ਦੀਆਂ ਗੱਲਾਂ ਸੁਣਦੇ ਰਹਿਦੇ ਹਾਂ ਜਿਵੇਂ ਕਿ ਪਿਛਲੇ ਹੀ ਦਿਨ ਮੇਰੇ ਇੱਕ ਦੋਸਤ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਇਆ ਸੀ ਜਿਸ ਦੇ ਵਿੱਚ ਉਸ ਦੇ ਅਕਾਊਂਟ ਰਾਹੀ ਬਿਨਾਂ ਉਸ ਦੀ ਉਸ ਦੀ ਸਹਾਇਤਾ ਤੋਂ ਕੋਈ ਉਸਦੇ ਅਕਾਊਂਟ ਨੂੰ ਇਸਤੇਮਾਲ ਕਰਕੇ ਕਿਸੇ ਵੀ ਅਲੱਗ ਅਲੱਗ ਅਕਾਊਂਟਾਂ 'ਤੇ ਮੈਸੇਜ ਕਰ ਰਿਹਾ ਸੀ ਜਾਂ ਕੁਝ ਨਾ ਕੁਝ ਹੋਰ ਇਨਫੋਰਮੇਸ਼ਨ ਭੇਜ ਰਿਹਾ ਸੀ ਜੋ ਕਿ ਉਸ ਦੇ ਲਈ ਬਹੁਤ ਨੁਕਸਾਨਦਾਇਕ ਸਾਬਿਤ ਹੋਰ ਰਹੀਆਂ ਹਨ ਅਤੇ ਇਸ ਆਪਾਂ ਉਸ ਨੂੰ ਰੋਕਣ ਦੇ ਲਈ ਅਲੱਗ ਅਲੱਗ ਤਰੀਕੇ ਦੀਆਂ ਪ੍ਰੀਕਿਰਿਆਵਾਂ ਦਾ ਇਸਤੇਮਾਲ ਕੀਤਾ ਜਿਵੇਂ ਕਿ ਅਸੀਂ

ਨੂੰ ਸਾਰੇ ਮੈਸੇਜਾਂ ਨੂੰ ਡਿਲੀਟ ਕੀਤਾ ਅਤੇ ਉਸ ਦੇ ਸਕਰੀਨਸ਼ੋਟ ਲੈ ਕੇ ਸਾਈਬਰ ਕ੍ਰਾਈਮ ਗਵਰਮੈਂਟ ਦੀ ਹੈਲਪ ਲਈ ਅਤੇ ਉਸ ਨੂੰ ਅਪਲੋਡ ਕਰਕੇ ਉਸ ਦੀ ਕੰਪਲੇਂਟ ਕੀਤੀ ਅਤੇ ਜਿਸ ਦੇ ਨਾਲ ਸਾਨੂੰ ਉਹਨਾਂ ਦੀ ਸਹਾਇਤਾ ਨਾਲ ਉਸ ਹੈਕ ਕਰਨ ਵਾਲੇ ਵਿਅਕਤੀ ਦਾ ਸਾਰਾ ਡੇਟਾ ਪਤਾ ਲੱਗਿਆ ਅਤੇ ਉਹ ਪਕੜਿਆ ਗਿਆ ਜਿਸ ਦੀ ਇਸ ਤਰੀਕੇ ਨਾਲ ਅਸੀਂ ਸਰਕਾਰ ਦੀ ਮਦਦ ਲੈ ਕੇ ਉਸ 'ਤੇ ਕਾਰਵਾਈ ਕੀਤੀ